ਜੇਕਰ ਮੈਂ ਪੰਜਾਬ ਵਿੱਚ ਬਿਜਲੀ ਦੀ ਗੱਲ ਕਰਾਂ ਤਾਂ ਪੰਜਾਬ ਵਿੱਚ ਕੋਈ ਬਿਜਲੀ ਦੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੈ ਪਰ ਕਈ ਕ ਵਾਰ ਜਦੋਂ ਮੀਂਹ ਦੇ ਜਿਵੇਂ ਕਿ ਮੌਸਮ ਵਿ ਮੌਸਮਾਂ ਦੇ ਕਾਰਨ ਅਸੀਂ ਕਹੀਏ ਤਾਂ ਜਦ ਮੀਂਹ ਪੈ ਜਾਂਦਾ ਹੈ ਤਾਂ ਕੁਛ ਕੁ ਤਾਰਾਂ ਵੀ ਟੁੱਟ ਜਾਂਦੀਆਂ ਹਨ ਜਾਂ ਕੋਈ ਸ਼ੋਟ ਸਰਕਟ ਹੋ ਜਾਂਦਾ ਹੈ ਜਿਸ ਕਾਰਨ ਕਈ ਕਈ ਘੰਟਿਆਂ ਤੱਕ ਗਰਮੀ ਦੇ ਵਿੱਚ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ ਜਿਹਨਾਂ ਕਾਰਨ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਘਰ ਦੇ ਛੋਟੇ ਬੱਚਿਆਂ ਨੂੰ ਤਾਂ ਜ਼ਿਆਦਾ ਦਿੱਕਤ ਆਉਂਦੀ ਹੈ ਅਤੇ ਘਰ ਦੇ ਬਜ਼ੁਰਗਾਂ ਨੂੰ ਵੀ ਇਸ ਕਾਰਨ ਬਹੁਤ ਦਿੱਕਤ ਆਉਂਦੀ ਹੈ ਜੇਕਰ ਬਿਜਲੀ ਦੇ ਕੱਟ ਕਈ ਕਈ ਵਾਰ ਤਾਂ ਬਿਜਲੀ ਦੇ ਕੱਟ ਪੂਰਾ ਪੂਰਾ ਦਿਨ ਹੀ ਲੱਗੇ ਰਹਿੰਦੇ ਹਨ ਜਿਸ ਕਾਰਨ ਸ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਜੇ ਬਿਜਲੀ ਦਫਤਰ ਦੇ ਲੋਕ ਖੁਦ ਹੀ ਬਿਜਲੀ ਦਾ ਕੱਟ ਲਾ ਦਿੰਦੇ ਹਨ ਕਈ ਵਾਰ ਮੀਂਹ ਜ਼ਿਆਦਾ ਆਉਂਦਾ ਹੈ ਜਾਂ ਹਨੇਰੀਆਂ ਆ ਜਾਂਦੀਆਂ ਹਨ ਜਿਸ ਨਾਲ ਜੇਕਰ ਕੋਈ ਤਾਰ ਜਿਹ 'ਚ ਸ਼ੋਟ ਸਰਕਟ ਵਗੈਰਾ ਹੋ ਜੇ ਜਿਸ ਨਾਲ ਲੋਕਾਂ ਨੂੰ ਨੁਕਸਾਨ ਨਾ ਹੋਵੇ ਇਸ ਲਈ ਉਹ ਖੁਦ ਹੀ ਕੱਟ ਲਗਾ ਦਿੰਦੇ ਹਨ ਕੱਟ ਲੱਗਣ 'ਤੇ ਤਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਸ ਕਾਰਨ ਇ ਇਹਨਾਂ ਚੀਜ਼ਾਂ ਕਾਰਨ ਹੀ ਅਸੀਂ ਜਿਸ ਕਾਰਨ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਬਿਜਲੀ ਦੇ ਕੱਟਾਂ ਕਰਕੇ